ਫਸਲਾਂ ਦੇ ਰਿਲੇਟਡ ਮੌਸਮਾਂ ਦੇ ਵਿੱਚ ਜਿਵੇਂ ਕਿ ਠਾ ਸਰਦੀ ਦੇ ਮੌਸਮ ਦੇ ਵਿੱਚ ਕਣਕ ਦੀ ਪੈਦਾਵਾਰ ਹੁੰਦੀ ਹੈ ਅਤੇ ਗਰਮੀ ਦੇ ਮੌਸਮ ਦੇ ਵਿੱਚ ਝੋਨੇ ਦੀ ਪੈਦਾਵਾਰ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਕਾਫੀ ਖੇਤਰਾਂ ਦੇ ਵਿੱਚ ਸਬਜ਼ੀ ਅਤੇ ਗੰਨੇ ਦੀ ਪੈਦਾਵਾਰ ਵੀ ਕਾਫੀ ਹੁੰਦੀ ਹੈ ਅਤੇ ਜਿਵੇਂ ਕਿ ਫਤਿਹਗੜ੍ਹ ਸਾਹਿਬ ਏਰੀਏ ਦੇ ਵਿੱਚ ਗੰਨੇ ਦੀ ਪੈਦਾਵਾਰ ਕਾਫੀ ਕੀਤੀ ਜਾਂਦੀ ਹੈ ਅਤੇ ਮਾਲਵੇ ਦੇ ਹੋਰ ਏਰੀਏ ਜਿਵੇਂ ਕਿ ਸੰਗਰੂਰ ਇਲਾਕੇ ਦੇ ਏਰੀਏ ਦੇ ਵਿੱਚ ਮੂੰਗੀ ਮਸਰੀ ਦੀਆਂ ਦਾਲਾਂ ਅਤੇ ਮੱਕੀ ਆਦਿ ਦੀ ਬਿਜਾਈ ਕਾਫੀ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਗੰਨਾ